ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਮੈਨੇਜਰ ਸਾਹਿਬ ਮੈਂ ਯੂਟੀਊਬ ਬਲੋਗਰ ਬੋਲ ਰਿਹਾ ਜੀ ਰਾਣਾ ਗੁਰਦੀਪ ਸਿੰਘ ਅਤੇ ਮੈਂ ਤੁਹਾਡਾ ਫੋਨ ਨੰਬਰ ਇੰਟਰਨੈਟ ਤੋਂ ਲਿਆ ਸੀਗਾ ਹੁਣ ਅਤੇ ਮੈਂ ਫਤਿਹਗੜ੍ਹ ਸਾਹਿਬ ਬਾਰੇ ਵਲੋਗਿੰਗ ਕਰਨਾ ਚਾਹੁੰਦਾ ਅਤੇ ਤੁਸੀਂ ਕਿਹੜਾ ਆ ਗੁਰਦੁਆਰਾ ਸਾਹਿਬ 'ਚ ਪੋਸਟਡ ਹੋ ਜੀ ਇਸ ਟਾਇਮ ਅੱਛਾ ਅੱਛਾ ਇਹਨਾਂ ਨੇ ਆਪਣੇ ਇੱਥੇ ਆਪਣੇ ਇੱਥੇ ਕਿੰਨੇ ਗੁਰਦੁਆਰਾ ਸਾਹਿਬ ਹੈਗੇ ਨੇ ਜੀ ਫਤਿਹਗੜ੍ਹ ਸਾਹਿਬ ਅੱਛਾ ਜੀ

ਹਾਂਜੀ

ਅੱਛਾ ਹਾਂਜੀ ਅੱਛਾ ਤੁਸੀਂ ਮੈਨੂੰ ਇਹਨਾਂ ਦੇ ਬਾਰੇ ਬਰੀ ਬਰੀਫ ਇਤਿਹਾਸ ਦੇਵੋਂਗੇ ਤਾਂ ਕਿ ਮੈਂ ਇਹਨਾਂ ਦਾ ਨਾ ਯੂਟਿਊਬ ਵਲੋਗਿੰਗ ਕਰਨਾ ਚਾਹੁੰਦਾ ਅਤੇ ਆਪਣੇ ਉਹਦੇ 'ਤੇ ਇੰਟਰਨੈਟ 'ਤੇ ਪਾਉਣਾ ਚਾਹੁੰਦਾ ਤਾਂ ਕਿ ਟੂਰਿਜ਼ਮ ਆਪਣਾ ਜਿਹੜਾ ਰਿਲੀਜੀਅਸ ਟੂਰਿਜ਼ਮ ਆ ਉਹ ਵੱਧ ਜੂਗਾ ਥੋੜ੍ਹਾ ਜਿਹਾ ਹਾਂਜੀ ਹਮ ਅੱਛਾ ਜੀ ਅੱਛਾ ਹਾਂਜੀ ਹਾਂਜੀ

ਹਾਂਜੀ

ਹਾਂਜੀ ਹਾਂਜੀ

ਹਾਂਜੀ ਹਾਂਜੀ ਨਹੀਂ ਸਭ ਤੋਂ ਮਹਿੰਗੀ ਤਾਂ ਹੋਣੀ ਹੈ ਜੀ ਜੋ ਖੜ੍ਹੀਆਂ ਮੋਹਰਾਂ ਕਰਕੇ ਲਈ ਹੈ ਜ਼ਮੀਨ ਹਾਂ ਦੁਨੀਆ ਹਾਂਜੀ ਅਤੇ ਗੁਰਦੁਆਰਾ ਸ਼ੀਸ਼ ਗੰਜ ਸਾਹਿਬ ਜੀ ਚਲੋ ਠੀਕ ਚਲੋ ਠੀਕ ਆ ਮੈਨੇਜਰ ਸਾਹਿਬ ਮੈਂ ਥੋੜ੍ਹੀ ਜਿਹੀ ਬਲੋਗਿੰਗ ਕਰਕੇ ਦੇਖਦਾ ਜੇ ਮੇਰਾ ਕੰਮ ਠੀਕ ਰਿਹਾ ਤਾਂ ਮੈਂ ਇਹਨੂੰ ਵਲੋਗਿੰਗ ਪਾ ਕੇ ਤੁਹਾਨੂੰ ਕਾਪੀ ਭੇਜ ਦੂਗਾ ਜੇ ਕੁਛ ਆਪਾਂ ਰੈਕਟੀਫਕੇਸ਼ਨ ਕਰਨੀ ਹੋਈ ਠੀਕ ਕਰਨਾ ਹੋਇਆ ਤਾਂ ਤੁਸੀਂ ਦੇਖ ਲਿਓ ਉਦੂ ਬਾਅਦ ਮੈਂ ਤੁਹਾਨੂੰ ਆ ਕੇ ਮਿਲਾਂਗਾ ਵੀ ਜਦੋਂ ਫਤਿਹਗੜ੍ਹ ਸਾਹਿਬ ਆਏ ਉਦੇ ਜ਼ਰੂਰ ਮਿਲਾਂਗੇ ਜੀ ਠੀਕ ਆ ਓਕੇ ਜੀ ਓਕੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ